ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਸਾਡੀ ਸੋਸਾਇਟੀ ਰਹਿਮਤ ਸੇਵਾ ਸੋਸਾਇਟੀ ਚੱਲ ਰਹੀ ਹੈ ਅੱਛਾ ਜੀ ਹਾਂ ਮੇਨ ਸਾਡਾ ਜਿਹੜਾ ਫੋਕਸ ਆ ਉਹ ਐਜੂਕੇਸ਼ਨ 'ਤੇ ਆ ਬੱਚਿਆਂ ਦੀ ਸਟਡੀ 'ਤੇ ਅਤੇ ਸ ਉਹਦੇ ਲਈ ਅਸੀਂ ਜਿਹੜੇ ਬੱਚੇ ਅਡੋਪਟ ਕਰਦੇ ਹਾਂ ਜਿਹੜੇ ਬਿਲੋ ਪਵਰਟੀ ਲਾਈਨ ਨੇ ਉਹ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਜਿਹੜੀ ਆ ਵਧੀਆ ਸਿੱਖਿਆ ਪ੍ਰਣਾਲੀ ਜਿਹੜੀ ਆ ਵਧੀਆ ਸਕੂਲਿੰਗ ਉਹਨਾਂ ਦੀ ਉਹਦਾ ਕਰਵਾਉਣ ਦਾ ਯਤਨ ਕਰਦੇ ਹਾਂ ਅਸੀਂ ਅਤੇ ਉਹ ਬੱਚਾ ਜਦੋਂ ਅਸੀਂ ਇੱਕ ਵਾਰ ਉਹਨੂੰ ਹਾਂ ਗੋਦ ਲੈ ਲੈਂਦੇ ਹਾਂ ਜਾਂ ਅਡੋਪਟ ਕਰ ਲੈਂਦੇ ਹਾਂ ਤਾਂ ਬਾਰ੍ਹਵੀਂ ਜਮਾਤ ਤੱਕ ਉਹਦੀ ਜਿਹੜੀ ਸਾਰੀ ਫੀਸ ਆ ਉਹ ਅਸੀਂ ਭਰਦੇ ਹਾਂ

ਨਹੀਂ ਇਹ ਇੱਕ ਐਨਜੀਓ ਆ ਜੀ ਨੋਨ ਗਵਰਮੈਂਟ ਆਰਗਨਾਈਜੇਸ਼ਨ ਆ ਹਾਂ ਜਿਹਦੇ ਵਿੱਚ ਕੋਈ ਇਡਾ ਅਹਿਮ ਰੋਲ ਸਰਕਾਰ ਦਾ ਨਹੀਂ ਹੈਗਾ ਇਹ ਇੱਕ ਸੋਸ਼ਲਿਸਟ ਜਿਹੜੇ ਨੇ ਜਾਂ ਜਿਹੜੀ ਸਾਡੀ ਡੋਨੇਸ਼ਨ ਆਉਂਦੀ ਆ ਕੁਲੀਗਸ ਤੋਂ ਜਾਂ ਸਾਡੇ ਉਹ ਡੋਨੇਸ਼ਨ ਦੇ ਬੇਸਿਸ 'ਤੇ ਇਹ ਜਿਹੜਾ ਸਾਰਾ ਚੱਲਦਾ ਜੀ ਹਾਂ ਉਹ ਸੀਬੀਐਸਈ ਪੈਟਰਨ ਦੇ ਸਕੂਲ ਹੁੰਦੇ ਨੇ ਜਿਹੜੇ ਉਹਨਾਂ ਨੂੰ ਲੋਕਲ ਪੈਂਦੇ ਨੇ ਜਿਹੜੇ ਉਹਨਾਂ ਦੇ ਏਰੀਏ ਦੇ ਵਿੱਚ ਹੁੰਦੇ ਨੇ ਅਤੇ ਉਹ ਹੀ ਸਕੂਲ ਹੁੰਦੇ ਨੇ ਆਲਮੋਸਟ ਜਿਹੜੇ ਉਹਨਾਂ ਨੂੰ ਨੇੜੇ ਪੈਂਦੇ ਆ ਜਿੱਥੇ ਟ੍ਰਾਂਸਪੋਰਟੇਸ਼ਨ ਦਾ ਉਹਨਾਂ ਦਾ ਖਰਚਾ ਘੱਟ ਜਾਏ ਬੱਚਿਆਂ ਦਾ ਅਤੇ ਵਧੀਆ ਉਹਨਾਂ ਨੂੰ ਐਜੂਕੇਸ਼ਨ ਜਿੱਥੇ ਆਲਰੇਡੀ ਉਹ ਲੈ ਰਹੇ ਨੇ ਉੱਥੇ ਹੀ ਅਸੀਂ ਹੈਲਪ ਕਰਦੇ ਹਾਂ

ਫੂਡ ਹਾਂ ਫੂਡ ਦਾ ਜਿਹੜਾ ਆਲਰੇਡੀ ਆ ਉਹ ਅਸੀਂ ਕਿਟਸ ਪ੍ਰੋਵਾਈਡ ਕਰਦੇ ਹਾਂ ਉਹ ਮੰਥਲੀ ਜਿਹੜੀਆਂ ਕਿਟਸ ਨੇ ਉਹਨਾਂ ਨੂੰ ਮਹੀਨੇ ਤੋਂ ਮਹੀਨੇ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਉਹਨਾਂ ਨੂੰ ਵਧੀਆ ਜਿਹੜੀ ਜਿਹੜੀ ਇੱਕ ਡਾਇਟ ਜਿਹੜੀ ਚੰਗੀ ਖੁਰਾਕ ਆ ਉਹ ਚੰਗੀ ਖੁਰਾਕ ਉਹਨਾਂ ਦੇ ਘਰਾਂ ਤੱਕ ਪਹੁੰਚ ਸਕੇ ਉਹ ਉਹ ਕਿੱਟਸ ਬਣਾ ਕੇ ਉਹ ਬੈਗ ਪੈਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਏ ਜਾਂਦੇ ਨੇ ਉਹਦੇ ਲਈ ਜਿਹੜਾ ਉਹ ਸਕੂਲ ਦੀਆਂ ਐਟੀਵੀਟਿਸ ਹੁੰਦੀਆਂ ਨੇ ਕਿਉਂਕਿ ਅਸੀਂ ਆਲਰੇਡੀ ਜਿਹੜੇ ਬੱਚੇ ਨੇ ਉਹ ਸਕੂਲ 'ਚ ਜਾਂਦੇ ਨੇ ਤੇ ਸਾਡੀ ਜਿਹੜੀ ਐਨਜੀਓ ਆ ਉਹ ਬੱਚਿਆਂ ਨੂੰ ਫਾਈਨੈਂਸ਼ੀਅਲੀ ਜਿਹੜੀ ਆ ਉਹ ਸਪੋਰਟ ਕਰਦੀ ਆ ਉਹਨਾਂ ਦੀ ਪ ਪੈਸੇ ਦੇ ਤੌਰ 'ਤੇ ਜਿਹੜੀ ਉਹ ਮਦਦ ਕੀਤੀ ਮਾਲੀ ਮਦਦ ਕੀਤੀ ਜਾਂਦੀ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ